ਪੰਦਰਾਂ ਪੰਜ ਸੌ ਵੀਹ ਪੰਜ ਹਜ਼ਾਰ ਪੰਜ ਸੌ ਪੱਚੀ ਛਿਹੱਤਰ ਹਜ਼ਾਰ ਦੋ ਸੌ ਇਕਵੰਜਾ ਨੌ ਲੱਖ ਤੇਈ ਹਜ਼ਾਰ ਪੰਜ ਸੌ ਵੀਹ